ਕੀ ਤੁਸੀਂ ਕਦੇ ਸੋਚਿਆ ਹੈ ਕਿ ਗੈਸ ਅਤੇ ਅਡਿਕਸ਼ਨ ਵਿਚਕਾਰ ਖਾਣਾ ਪਕਾਉਣ ਲਈ ਕੀ ਜ਼ਿਆਦਾ ਫਾਇਦੇਮੰਦ ਅਤੇ ਹੋਵੇਗਾ ਖਾਣਾ ਪਕਾਉਣ ਲਈ ਬਜ਼ਾਰ ਵਿੱਚ ਗੈਸ ਚੁੱਲ੍ਹੇ ਉਪਲਬਧ ਹਨ ਇਸ ਦੇ ਸਿਖਰ 'ਤੇ ਇੱਕ ਬਰਨਰ ਲਗਾ ਲਗਾਇਆ ਗਿਆ ਹੈ ਜਿਸ ਵਿੱਚ ਲਾਟ ਲਈ ਐਲ ਪੀ ਜੀ ਦੂਜੇ ਪਾਸੇ ਅਡਿਕਸ਼ਨ ਵਿੱਚ ਬਿਜਲੀ ਦੀ ਵਰਤੋਂ ਕਰਕੇ ਭੋਜਨ ਪਕਾਇਆ ਜਾਂਦਾ ਹੈ ਅਡਿਕਸ਼ਨ ਵਿੱਚ ਬਿਜਲੀ ਦੀ ਵਰਤੋਂ ਕਰਕੇ ਭੋਜਨ ਪਕਾਇਆ ਜਾਂਦਾ ਹੈ ਇਹ ਖਾਣਾ ਪਕਾਉਣ ਲਈ ਸਟੀਲ ਚੁੰਬਕੀ ਬਲ ਦੀ ਵਰਤੋਂ ਕਰਦਾ ਹੈ ਪਰ ਇਸ ਨੂੰ ਪਕਾਉਣ ਲਈ ਕਿਸੇ ਲਾਟ ਦੀ ਲੋੜ ਨਹੀਂ ਪੈਂਦੀ ਇਹ ਸਿੱਧੇ ਭਾਂਡੇ ਨੂੰ ਗਰਮ ਕਰਦਾ ਹੈ ਜਿਸ ਰਾਹੀਂ ਭੋਜਨ ਪਕਾਇਆ ਜਾਂਦਾ ਹੈ ਗੈਸ ਚੁੱਲ੍ਹੇ 'ਤੇ ਖਾਣਾ ਬਣਾਉਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਬਿਜਲੀ ਦੇ ਕੱਟਾਂ ਦੀ ਚਿੰਤਾ ਨਹੀਂ ਕਰਨੀ ਪੈਂਦੀ ਅਤੇ ਨਾ ਹੀ ਤੁਹਾਨੂੰ ਬਿਜਲੀ 'ਤੇ ਨਿਰਭਰ ਰਹਿਣਾ ਪੈਂਦਾ ਹੈ ਇਸ 'ਚ ਤੁਸੀਂ ਅਲਮੀਨੀਅਮ ਅਤੇ ਸਟੀਲ ਤੋਂ ਲੈ ਕੇ ਲੋਹੇ ਜਾਂ ਪਿੱਤਲ ਤੱਕ ਦੇ ਕਿਸੇ ਵੀ ਬਰਤਨ 'ਚ ਖਾਣਾ ਬਣਾ ਸਕਦੇ ਹੋ ਗੈਸ ਦੇ ਦੋ ਤੋਂ ਚਾਰ ਬਰਨਰ ਹਨ ਤੁਸੀਂ ਆਪਣੀ ਸਹੂਲਤ ਅਨੁਸਾਰ ਬਰਨਰਾਂ ਦੀ ਗਿਣਤੀ ਨਾਲ ਗੈਸ ਖਰੀਦ ਸਕਦੇ ਹੋ ਗੈਸ ਸਟੋਵ ਨੂੰ ਨੁਕਸਾਨਦਈ ਮੰਨਿਆ ਜਾਂਦਾ ਹੈ ਕਿਉਂਕਿ ਉਹ ਜਲਣਸ਼ੀਲ ਹੁੰਦੇ ਹਨ ਇਸ ਤੋਂ ਇਲਾਵਾ ਇਸ ਦੀ ਲਾਟ ਕਾਰਨ ਸੜਨ ਦਾ ਖਤਰਾ ਹੈ ਗੈਸ 'ਚ ਖਾਣਾ ਪਕਾਉਣ ਨਾਲ ਆਲੇ ਦੁਆਲੇ ਦਾ ਵਾਤਾਵਰਨ ਵੀ ਗਰਮ ਹੋ ਜਾਂਦਾ ਇਸ ਕਾਰਨ ਕਮਰਾ ਹਮੇਸ਼ਾ ਗਰਮ ਰਹਿੰਦਾ ਹੈ ਊਰਜਾ ਦੀ ਵਰਤੋਂ ਦੇ ਮਾਮਲੇ ਵਿੱਚ ਅਡਿਕਸ਼ਨ ਨੂੰ ਸਭ ਤੋਂ ਵੱਧ ਕੁਸ਼ਲ ਮੰਨਿਆ ਜਾਂਦਾ ਹੈ ਇਸ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਦੇ ਵਿਕਲਪ ਹਨ ਊਰਜਾ ਦੀ ਵਰਤੋਂ ਦੇ ਮਾਮਲੇ ਵਿੱਚ ਅਡਿਕਸ਼ਨ ਨੂੰ ਸਭ ਤੋਂ ਵੱਧ ਕੁਸ਼ਲ ਮੰਨਿਆ ਜਾਂਦਾ ਹੈ ਇਸ ਵਿੱਚ ਤਾਪਮਾਨ ਨੂੰ ਕੰਟਰੋਲ ਕਰਨ ਦੇ ਵਿਕਲਪ ਹਨ